ਸਰਕਾਰ ਦੁਆਰਾ ਪੋਲਸੀ ਗੇਮਿੰਗ ਉਦਯੋਗ ਜਾਰੀ ਕਰਨ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਿੱਚ ਬਹੁਤ ਮਦਦ ਮਿਲਦੀ ਹੈ ਇਸ ਮੁਹਿੰਮ ਦੇ ਤਹਿਤ ਕੋਈ ਵੀ ਨੌਜਵਾਨ ਆਪਣੀ ਗੇਮ ਦੇ ਸਹਾਇਤਾ ਦੇ ਨਾਲ ਉਸ ਦੇ ਵਿੱਚ ਵਧੀਆ ਪਦਵੀ ਤੇ ਕੁਛ ਮੁਕਾਮ ਹਾਸਲ ਕਰਨ ਦੇ ਨਾਲ ਕਿਸੇ ਵੀ ਸਰਕਾਰੀ ਰੁਜ਼ਗਾਰ ਦੇ ਵਿੱਚ ਅਪਲਾਈ ਕਰ ਸਕਦਾ ਹੈ ਜਿਸ ਵਿੱਚ ਉਸਨੂੰ ਬਹੁਤ ਮਦਦ ਮਿਲੇਗੀ ਸਰਕਾਰੀ ਮਹਿਕਮੇ ਵਿੱਚ ਉਸਨੂੰ ਉੱਚ ਪੱਧਰ 'ਤੇ ਰੁਜ਼ਗਾਰ ਮਿਲ ਸਕਦਾ ਹੈ